ਹਾਂਜੀ ਤੁਸੀਂ ਲੋਟਸ ਕਲੱਬ ਤੋਂ ਮੈਮ ਬੋਲ ਰਹੇ ਐ ਹਾਂਜੀ ਮੈਮ ਮੇਰਾ ਨਾਂਅ ਜੋਤੀ ਐ ਤੇ ਮੇਰੇ ਬੱਚੇ ਦਾ ਨਾਮ ਮਲਿਕ ਆ ਹਾਂਜੀ ਮੈਮ ਮੈਂ ਤਾਡੇ ਨਾਲ ਗੱਲ ਕਰਨੀ ਸੀ ਐਕਟੀਵਿਟਸ ਦੇ ਰਿਗਾਡਿੰਗ ਜਿੱਦਾਂ ਹੁਣ ਤੁਹਾਨੂੰ ਪਤਾ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਰਹੀਆਂ ਸਮਰ ਵਿੱਚ ਹੈਨਾ ਸਮਰ ਦੀਆਂ ਛੁੱਟੀਆਂ ਔਣ ਡਈਆਂ ਵਾ ਤੇ ਹਫ਼ਤਾ ਈ ਬਚ ਰਹਿ ਗਿਆ ਉਨ੍ਹਾਂ ਦਾ ਸਕੂਲ ਜਾਣ ਨੂੰ ਤੇ ਮੈਂ ਤੁਹਾਨੂੰ ਪੁੱਛਣਾ ਤਾਡੇ ਮੈਮ ਆਪਣੇ ਬੱਚਿਆਂ ਨੂੰ ਤਾਡੇ ਐਕਟੀਵਿਟੀ ਕਾਫ਼ੀ ਮੈਂ ਸੁਣਿਆ ਲੋਕਾਂ ਕੋ ਮੀਨਸ ਲਾਇਕ ਕੀ ਕਾਫ਼ੀ ਐਕਟਿਵਿਟੀਜ ਕਰੋਂਦੇ ਐ ਤੁਸੀਂ ਤੇ ਤੁਸੀਂ ਮੈਨੂੰ ਵਿਸਥਾਰ ਨਾਲ ਦੱਸੋ ਇਹ ਕਿੱਦਾਂ ਦੀਆਂ ਐਕਟੀਵਿਟੀਸ ਤਾਡੇ ਲੋਟਸ ਕਲੱਬ ਵਿੱਚ ਕਰਾਈਆਂ ਜਾਂਦੀਆਂ ਅਨ ਮੇਰੇ ਜਿੱਦਾਂ ਮੈਂ ਬੱਚਿਆਂ ਨੂੰ ਛੁੱਟੀਆਂ ਹੋਣ ਵਾਲੀਆਂ ਮੇਰੇ ਬੇਟਾ ਵਾ ਮੈਮ ਉਹਦੀ ਏਜ ਹੈਗੀ ਮੈਮ ਫਾਈਵ ਈਅਰਸ ਪੰਜ ਸਾਲ ਦਾ ਹਾਂਜੀ ਠੀਕ ਐ ਮੈਮ ਹਾਂਜੀ ਹਾਂਜੀ ਠੀਕ ਐ ਜੀ ਹਾਂਜੀ ਹਾਂਜੀ ਠੀਕ ਐ ਮੈਂ ਆਪਣੇ ਬੱਚੇ ਨੂੰ ਜਿੱਦਾਂ ਡਰਾਇੰਗ 'ਚ ਕਰੋਣਾ ਵਾ ਪੇਂਟਿੰਗ ਉਹਨੂੰ ਬਹੁਤ ਪਸੰਦ ਐ ਡਰਾਇੰਗ ਕਰਨਾ ਪਸੰਦ ਐ ਡਾਂਸ ਕਰਨਾ ਪਸੰਦ ਐ ਉਹਨੂੰ ਤੇ ਮੈਂ ਚਾਹੰਦੀ ਇੱਦਾਂ ਦੀ ਐਕਟਿਵਿਟੀਜ ਉਹ ਮਤਲਬ ਤੁਹਾਡੇ ਕੋਲ ਆ ਕੇ ਪਰਫੋਮ ਕਰੇ ਹਨਾ ਹਾਂਜੀ ਮਤਲਬ ਕਿੰਨੀਆਂ ਐਕਟਿਵਿਟੀਜ ਇੰਕਲਿਊਡ ਹੈਗੀਆਂ ਤਾਡੇ ਮਤਲਬ ਹਾਂਜੀ ਹਾਂਜੀ ਤੇ ਸਮਾਨ ਤੁਸੀਂ ਦਓਗੇ ਕਿ ਸਾਨੂੰ ਮਤਲਬ ਘਰੋਂ ਭੇਜਣਾ ਪੈਣਾ ਸਮਾਂ ਕਲਰ ਕੁਲਰ ਦਾ ਹਾਂਜੀ ਤੇ ਮੈਮ ਤੁਹਾਨੂੰ ਪੁੱਛਣਾ ਸੀ ਕੀ ਮਤਲਬ ਕਿੰਨੇ ਚਾਰਜਸ ਨੇ ਇਸ ਕਲੱਬ ਦੇ ਵਿੱਚ ਕਿੰਨੇ ਠੀਕ ਐ ਜੀ ਠੀਕ ਐ ਮੈਮ ਹੋਰ ਕਿਹੜੀਆਂ ਐਕਟਿਵਿਟੀਜ ਫਿਜੀਕਲ ਐਕਟਿਵਿਟੀਜ ਕਿਹੜੀਆਂ ਹੈਗੀਆਂ ਜਿਹੜੀਆਂ ਆਊਟਸਾਈਡ ਓਕੇ ਮੈਨੂੰ ਵੀ ਮੈਡਮ ਫਿਜੀਕਲੀ ਵੀ ਐਕਟਿਵਿਟੀਜ 'ਚ ਵੀ ਪਰਫੋਮ ਕਰਵਾਣਾ ਵਾਂ ਮਤਲਬ ਉਹਦੇ ਚ ਇਹਦਾ ਨਾਮ ਲਿਖ ਲੋ ਹਾਂਜੀ ਮੇਰੇ ਬੱਚੇ ਦਾ ਨਾਮ ਮੈਮ ਦੇਵੰਸ਼ ਹਾਂਜੀ ਮੇਰਾ ਬੱਚਾ ਮੈਮ ਇਸ ਵੀਕ ਚ ਜਿਹੜਾ ਉਹਨੇ ਸਕੂਲ ਜਾਣਾ ਅਗਲੇ ਇਸ ਵੀਕ ਤੋਂ ਬਾਅਦ ਮੈਂ ਤੁਹਾਡੇ ਕੋਲ ਆਉਂਗੀ ਮੈਂ ਆਪਣਾ ਜੋ ਵੀ ਤਾਡਾ ਡਿਟੇਲ ਵਗੈਰਾ ਫੋਮ ਫਿੱਲ ਕਰਨਾ ਹੁੰਦਾ ਮੈਂ ਕਰਕੇ ਜਾਊਂਗੀ ਤੇ ਨਾਲੇ ਮੈਂ ਆਪਣੇ ਬੱਚੇ ਨੂੰ ਤੁਹਾਡੇ ਕੋਲ ਛੱਡ ਦੇਊਂਗੀ ਉਸ ਟਾਈਮ ਤਾਡੇ ਰਾਜਿਸਟਰੇਸ਼ਨ ਕਰਾਕੇ ਜਾਊਂਗੀ ਫੇਰ ਮੈਂ ਹਾਂਜੀ ਕਿੰਨੇ ਰਾਜਿਸਟ੍ਰੇਸ਼ਨ ਫੀਸ ਕਿੰਨੀ ਐ ਤੁਆਡੀ ਠੀਕ ਐ ਚਲੋ ਠੀਕ ਐ ਮੈਮ ਮੈਂ ਆਉਨੀ ਆਂ ਫਿਰ ਓਕੇ ਮੈਮ ਠੀਕ ਐ ਮੈਮ ਠੀਕ ਐ ਓਕੇ ਮੈਮ ਠੀਕ ਐ ਮਿਲਦੇ ਆਂ ਤੁਹਨੂੰ ਅਸੀਂ ਫੇਰ ਅਗਲੇ